ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਹੁਣ ਵਿਆਹਵਾਂ ਦਾ ਸੀਜਨ ਚੱਲ ਰਿਹਾ ਵਿਆਹਾਂ ਵਰਗੇ ਵੱਡੇ ਸਮਾਰੋਹਾਂ ਦੌਰਾਨ ਵੱਡੀ ਮਾਤਰਾ ਵਿੱਚ ਪਾਣੀ ਦਾ ਪ੍ਰਬੰਧ ਕਰਨਾ ਬਹੁਤ ਹੀ ਮੁਸ਼ਕਿਲ ਹੋ ਜਾਂਦਾ ਹੈ ਥੋੜ੍ਹੇ ਦਿਨ ਪਹਿਲਾਂ ਹੀ ਮੇਰੇ ਚਾਚੇ ਦੇ ਮੁੰਡੇ ਦਾ ਵਿਆਹ ਸੀ ਅਸੀਂ ਉਸਦੇ ਵਿਆਹ ਉੱਤੇ ਗਏ ਜਦ ਮੈਂ ਉਹਨਾਂ ਨੂੰ ਮਿਲੀ ਤਾਂ ਉਹ ਵੀ ਕੁਝ ਇਸ ਤਰ੍ਹਾਂ ਦੀ ਮੁਸੀਬਤ ਦਾ ਸਾਹਮਣਾ ਕਰ ਰਹੇ ਸਨ ਉਹ ਵੀ ਪਾਣੀ ਦਾ ਪ੍ਰਬੰਧ ਕਰਨ ਦੀ ਕੋਸ਼ਿਸ਼ ਕਰ ਰਹੇ ਸਨ ਪਹਿਲਾਂ ਤਾਂ ਉਹਨਾਂ ਨੇ ਕੁਝ ਆਪਣੇ ਰੇਲੇਟਿਵਸ ਕੋਲੋਂ ਪਾਣੀ ਦਾ ਪ੍ਰਬੰਧ ਕਰਨ ਬਾਰੇ ਪੁੱਛਿਆ ਉਹਨਾਂ ਨੇ ਕੁਛ ਆਪਣੇ ਨੇਬਰਸ ਕੋਲੋਂ ਵੀ ਪੁੱਛਿਆ ਪਰ ਜਦ ਗੱਲ ਨਾ ਬਣੀ ਤਾਂ ਉਹਨਾਂ ਨੇ ਫਿਰ ਵੱਡੇ ਵੱਡੇ ਪਾਣੀ ਵਾਲੇ ਟੈਂਕਸ ਮੰਗਵਾ ਲਏ ਉਹਨਾਂ ਵਿੱਚੋਂ ਉਹਨਾਂ ਨੇ ਪਾਣੀ ਦੀ ਵਰਤੋਂ ਕੀਤੀ ਕਈ ਵਾਰ ਤਾਂ ਪਾਣੀ ਦਾ ਪ੍ਰਬੰਧ ਕਰਨਾ ਇੰਨਾ ਮੁਸ਼ਕਿਲ ਹੋ ਜਾਂਦਾ ਹੈ ਕਿ ਕੋਈ ਸਮੇਂ ਸਿਰ ਹੱਥ ਪੱਲਾ ਨਹੀਂ ਫੜਦਾ ਪਾਣੀ ਦਾ ਪ੍ਰਬੰਧ ਕਰਨਾ ਜਰੂਰੀ ਵੀ ਹੈ ਪਰ ਵਿਆਹ ਵਰਗੇ ਵੱਡੇ ਮੌਕਿਆਂ 'ਤੇ ਇਸ ਦਾ ਪ੍ਰਬੰਧ ਕਰਨਾ ਬਹੁਤ ਹੀ ਮੁਸ਼ਕਿਲ ਹੋ ਜਾਂਦਾ